ਪੁਰਾਣੇ ਸਮੇਂ ਨਾਲੋਂ ਅੱਜ ਦੇ ਸਮੇਂ ਵਿੱਚ ਪੰਜਾਬ ਦੇ ਸੱਭਿਆਚਾਰ 'ਚ ਬਹੁਤ ਫਰਕ ਆਇਆ ਹੈ ਕਿਉਂਕਿ ਉਰੇ ਸਮਾਂ ਸਮੇਂ 'ਤੇ ਹਮਲਾਵਾਰਾਂ ਨੇ ਜਦੋਂ ਹਮਲੇ ਕੀਤੇ ਨੇ ਉਰੇ ਆ ਕੇ ਵੱਸੇ ਨੇ ਤਾਂ ਉਹਨਾਂ ਦਾ ਅਸਰ ਤਾਂ ਸੱਭਿਆਚਾਰ 'ਤੇ ਲਾਜ਼ਮੀ ਹੈ ਪੈਣਾ ਜਿਵੇਂ ਕਿ ਪਹਿਲਾਂ ਮੁਗਲ ਆਏ ਮੁਗਲਾਂ ਨੇ ਆਪਣਾ ਜੋ ਰਾਜ ਕੀਤਾ ਉਰੇ ਉਹਨਾਂ ਦਾ ਅਸਰ ਪੰਜਾਬੀਆਂ ਦੇ ਭਾਸ਼ਾ 'ਤੇ ਪੰਜਾਬੀਆਂ ਦੇ ਵਿਰਸੇ 'ਤੇ ਦੇਖਣ ਨੂੰ ਮਿਲਦਾ ਹੈ ਪਹਿਰਾਵੇ ਦੇ ਵਿੱਚ ਫਰਕ ਪੈਂਦਾ ਹੈ ਖਾਣ ਪੀਣ ਦੇ ਵਿੱਚ ਫਰਕ ਪੈਂਦਾ ਹੈ ਕਿਉਂਕਿ ਜਿਹੋ ਜਿਹਾ ਰਾਜ ਹੁੰਦਾ ਉਹੋ ਜਿਹੀ ਜਨਤਾ ਮਤਲਬ ਕਿ ਉਹਨਾਂ ਨੂੰ ਫੋਲੋ ਕਰਦੀ ਹੈ ਜੋ ਆਪਾਂ ਕਹਿ ਸਕਦੇ ਹਾਂ ਕਿ ਇਸੇ ਤਰ੍ਹਾਂ ਹੀ ਬਾਅਦ ਵਿੱਚ ਬ੍ਰਿਟਿਸ਼ ਆ ਗਏ ਬ੍ਰਿਟਿਸ਼ ਸਰਕਾਰ ਜਦੋਂ ਆਈ ਹੈ ਤਾਂ ਆਪਣੇ ਨਾਲ ਅੰਗਰੇਜ਼ੀ ਭਾਸ਼ਾ ਲੈ ਕੇ ਆਈ ਆ ਆਪਣੇ ਨਾਲ ਕਈ ਸੁਧਾਰ ਲੈ ਕੇ ਆਈ ਆ ਜਿਹੜੇ ਉਹਨਾਂ ਨੇ ਕੁਛ ਮਾੜੇ ਕੰਮ ਕੀਤੇ ਅਤੇ ਕੁਛ ਉਪਲਬਧੀਆਂ ਵੀ ਨੇ ਜਿਵੇਂ ਕਿ ਰੇਲਵੇ ਸਟੇਸ਼ਨ ਹੋ ਗਏ ਸੜਕਾਂ ਹੋ ਗਈਆਂ ਉਹਨਾਂ ਨੇ ਇਹ ਸੁਧਾਰ ਵੀ ਕੀਤੇ ਅਤੇ ਆਪਣੇ ਨਾਲ ਜੋ ਉਹ ਆਪਣਾ ਵਿਰਸਾ ਲੈ ਕੇ ਆਏ ਉਸ ਦਾ ਅਸਰ ਵੀ ਪੰਜਾਬੀਆਂ ਦੇ ਉੱਤੇ ਦੇਖਿਆ ਦੇਖਣ ਨੂੰ ਮਿਲਦਾ ਹੈ ਸ਼ਬਦਾਂ ਵਿੱਚ ਵੀ ਲਾ ਲਓ ਅੱਜ ਵੀ ਆਪਣੇ ਜੋ ਕੁਝ ਅਜਿਹੇ ਸ਼ਬਦ ਨੇ ਜੋ ਕਿ ਉਰਦੂ ਭਾਸ਼ਾ ਅਤੇ ਉਹਨੇ ਫਾਰਸੀ ਤੋਂ ਨੇ ਅੰਗਰੇਜ਼ੀ ਭਾਸ਼ਾ ਤੋਂ ਨੇ ਉਹਨਾਂ ਦਾ ਪੰਜਾਬੀ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੂੰ ਉਚਾਰਨ ਵੀ ਪਤਾ ਹੋਵੇਗਾ ਜਿਸ ਤਰ੍ਹਾਂ ਫਰਦ ਹੋ ਗਈ ਅਤੇ ਅੰਗਰੇਜ਼ੀ ਵਾਲੇ ਰੇਲਵੇ ਸਟੇਸ਼ਨ ਹੋ ਗਿਆ ਹਸਪਤਾਲ ਹੋ ਗਿਆ ਇਹੋ ਜਿਹੇ ਕਈ ਸ਼ਬਦ ਨੇ ਜੋ ਸਾਨੂੰ ਬਾਹਰਲੀ ਭਾਸ਼ਾ ਤੋਂ ਬਾਹਰਲੇ ਸੱਭਿਆਚਾਰਾਂ ਤੋਂ ਦੇਖਣ ਨੂੰ ਮਿਲੇ ਹਨ ਧੰਨਵਾਦ